ਭਾਰਤ ਦੀ ਆਜ਼ਾਦੀ ਰਾਜਨੀਤੀ ਵਿੱਚ ਬਹੁਤ ਸਾਰੀ ਸਿਆਸੀ ਪਾਰਟੀਆਂ ਨੇ ਮੇਨ ਤੌਰ 'ਤੇ ਦੋ ਹੀ ਪਾਰਟੀਆਂ ਨੇ ਕਾਂਗਰਸ ਅਤੇ ਬੀ ਜੇ ਪੀ ਸੈਂਟਰ ਦੇ ਵਿੱਚ ਕਦੇ ਬੀ ਜੇ ਪੀ ਦੀ ਸਰਕਾਰ ਆਉਂਦੀ ਅਤੇ ਕਦੇ ਸੈਂਟਰ ਕਾਂਗਰਸੀ ਸਰਕਾਰ ਹੁੰਦੀ ਹੈ ਬਟ ਜਦੋਂ ਦੋਨੋਂ ਪਾਰਟੀਆਂ ਦੀ ਜੋ ਵਿਚਾਰਧਾਰਾ ਹੈ ਅਤੇ ਇੱਕ ਦੂਜੇ ਤੋਂ ਬਿਲਕੁਲ ਵੱਖਰੀ ਹੈ ਕਾਂਗਰਸ ਦੀ ਵਿਚਾਰਧਾਰਾ ਕੁੱਛ ਹੋਰ ਹੈ ਪਰ ਬੀ ਜੇ ਪੀ ਦੇ ਵਿਚਾਰਧਾਰਾ ਕੁੱਛ ਹੋਰ ਹੈ ਅਤੇ ਜੋ ਮੈਂ ਸੈਂਟਰ ਦੇ ਵਿੱਚ ਅੱਜ ਕੱਲ੍ਹ ਬੀ ਜੇ ਪੀ ਦੀ ਸਰਕਾਰ ਹੈ ਇਸ ਤੋਂ ਇਲਾਵਾ ਜਿਹੜਾ ਭਾਰਤੀ ਲੋਕਤੰਤਰ ਹੈ ਉਹ ਬਹੁਤ ਵਧੀਆ ਹੈ ਲੋਕਤੰਤਰ ਹੈ ਇਹਦੇ ਵਿੱਚ ਜੋ ਸਭ ਤੋਂ ਵੱਡੀ ਖਾਸੀਅਤ ਹੈਗੀ ਹੈ ਉਹ ਹੈਗਾ ਵੋਟ ਦਾ ਅਧਿਕਾਰ ਜਿਹਦੇ ਵਿੱਚ ਆਮ ਲੋਕ ਵੋਟਾਂ ਪਾ ਕੇ ਆਪਣੇ ਰਾਜਨੇਤਾ ਨੂੰ ਚੁਣਦੇ ਹਨ ਅਤੇ ਉਹੀ ਲੋਕ ਅੱਗੇ ਜਾ ਕੇ ਪ੍ਰਧਾਨ ਮੰਤਰੀ ਪੀ ਐੱਮ ਜਾਂ ਪੀ ਐੱਮ ਤੱਕ ਨੂੰ ਚੁਣਦੇ ਹਨ ਇਹ ਸਭ ਤੋਂ ਬੜੀ ਪਲੱਸ ਪੁਆਇੰਟ ਹੈਗੀ ਹੈ ਭਾਰਤੀ ਲੋਕਤੰਤਰ ਦਾ ਅੱਜ ਕੱਲ੍ਹ ਜੋ ਸਾਡੇ ਜੋ ਮੇਰੇ ਜੋ ਪਸੰਦੀਦਾ ਖ਼ੁਦ ਦੇ ਨੇਤਾ ਹਨ ਉਹ ਹਨ ਸ਼੍ਰੀ ਭਗਵੰਤ ਮਾਨ ਜੋ ਕਿ ਅੱਜ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਨੇ ਅਤੇ ਇਹਨਾਂ ਦੇ ਮੈਂ ਜਦੋਂ ਇਹਨਾਂ ਨੂੰ ਮਿਲਣਾ ਚਾਹੁੰਦਾ ਜਦੋਂ ਮੈਂ ਇਹਨਾਂ ਨੂੰ ਮਿਲਾਂਗਾ ਤਾਂ ਘੱਟੋ ਘੱਟ ਮੈਂ ਇਹਨਾਂ ਨੂੰ ਇੱਕ ਜਾਂ ਦੋ ਕੋਸ਼ਚਨ ਜ਼ਰੂਰ ਕਰਨਾ ਚਾਹਵਾਂਗਾ ਇੱਕ ਤਾਂ ਕਿਸਾਨਾਂ ਦੇ ਮੁੱਦੇ 'ਤੇ ਜਿਹਨਾਂ ਨਾਲ਼ ਗੱਲ ਕਰਨੀ ਜ਼ਰੂਰੀ ਹੈ ਕਿਸਾਨਾਂ ਦੇ ਮੁੱਦੇ ਜਿਹੜੇ ਹੈਗੇ ਆ ਉਹ ਕਦੋਂ ਤੱਕ ਹੱਲ ਹੋ ਜਾਣਗੇ ਅਤੇ ਸਿਰਫ਼ ਜੋ ਵੀ ਹੈਗਾ ਸਰਕਾਰੀ ਜਿਹੜਾ ਇੰਨਫਰਾਸਟਕਚਰ ਹੈਗਾ ਉਹ ਕਦੋਂ ਵਧੀਆ ਹੋਏਗਾ ਅਤੇ ਆਮ ਪਬਲਿਕ ਆਮ ਪਬਲਿਕ ਨੂੰ ਕਦੋਂ ਬਿਨਾਂ ਅਸਾਂ ਕਿਸੇ ਪਰੇਸ਼ਾਨੀ ਤੋਂ ਨਿਆਂ ਮਿਲ ਸਕੇਗਾ ਧੰਨਵਾਦ ਜੀ